ਪੰਜਾਬੀ ਸੱਭਿਆਚਾਰ ਵਿੱਚ ਖੇਡਾਂ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਜਦੋਂ ਕਿ ਵੀ ਪੰਜਾਬੀ ਲੋਕ ਵਿਹਲੇ ਹੁੰਦੇ ਹਨ ਤਾਂ ਉਹ ਆਪਣੇ ਆਂਢ ਗੁਆਂਢ ਦੇ ਬੱਚਿਆਂ ਨਾਲ ਖੇਡਣ ਲਈ ਚਲੇ ਜਾਂਦੇ ਹਨ ਜਿਵੇਂ ਕਿ ਕਬੱਡੀ ਗੁੱਲੀ ਡੰਡਾ ਆਦਿ ਅਜਿਹੀਆਂ ਖੇਡਾਂ ਖੇਡ ਕੇ ਉਹਨਾਂ ਦੇ ਸਰੀਰ ਤਾਕਤਵਰ ਹੋ ਜਾਂਦੇ ਹਨ ਕਿਉਂਕਿ ਜਦੋਂ ਵੀ ਉਹ ਮਿੱਟੀ ਉੱਪਰ ਇਹ ਖੇਡਾਂ ਖੇਡਦੇ ਹਨ ਤਾਂ ਮਿੱਟੀ ਦੇ ਤੱਤ ਉਹਨਾਂ ਦੇ ਸਰੀਰ ਨੂੰ ਲੱਗਦੇ ਹਨ ਜਿਸ ਨਾਲ ਉਹਨਾਂ ਦਾ ਸਰੀਰ ਲੋਹੇ ਵਰਗਾ ਹੋ ਜਾਂਦਾ ਹੈ ਅਤੇ ਉਹਨਾਂ ਨੂੰ ਬਿਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ ਕਿਉਂਕਿ ਖੇਡਾਂ ਖੇਡਣ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ ਅਤੇ ਉਹ ਆਪਣਾ ਜ਼ੋਰ ਵੀ ਲਗਾਉਂਦੇ ਰਹਿੰਦੇ ਹਨ ਖੇਡਾਂ ਦਾ ਇੱਕ ਇਹ ਵੀ ਲਾਭ ਹੈ ਕਿ ਜਦੋਂ ਵੀ ਇਹ ਬੱਚੇ ਆਪਣੀ ਪੜ੍ਹਾਈ ਕ ਪੜ੍ਹਾਈ ਕਰਕੇ ਥੱਕ ਜਾਂਦੇ ਹਨ ਤਾਂ ਉਹ ਆਪਣੇ ਦਿਮਾਗ ਨੂੰ ਤਾਜ਼ਾ ਕਰਨ ਲਈ ਖੇਡਣ ਲੱਗ ਜਾਂਦੇ ਹਨ ਜਿਸ ਨਾਲ ਉਹਨਾਂ ਦਾ ਦਿਮਾਗ ਨੂੰ ਸ਼ਾਂਤੀ ਮਿਲਦੀ ਹੈ ਅਤੇ ਉਹ ਦੁਬਾਰਾ ਜਦੋਂ ਪੜ੍ਹਾਈ ਕਰਨ ਲੱਗਦੇ ਹਨ ਤਾਂ ਉਹਨਾਂ ਦਾ ਦਿਮਾਗ ਜ਼ਿਆਦਾ ਚੱਲਦਾ ਹੈ ਅਤੇ ਉਹਨਾਂ ਦੀ ਪੜ੍ਹਾਈ ਵਿੱਚ ਵੀ ਡਿਵੈਲਪਮੈਂਟ ਹੁੰਦੀ ਹੈ ਅਤੇ ਇਸ ਦੇ ਨਾਲ ਹੀ ਜਦੋਂ ਬੱਚੇ ਟੀਮ ਵਿੱਚ ਖੇਡਦੇ ਹਨ ਤਾਂ ਉਹਨਾਂ ਵਿਚ ਇਮੋਸ਼ਨਲ ਡਿਵੈਲਪਮੈਂਟ ਵੀ ਹੁੰਦੇ ਹੁੰਦੀ ਹੈ ਅਤੇ ਉਹ ਇਮੋਸ਼ਨਲੀ ਇੱਕ ਦੂਜੇ ਨਾਲ ਜੁੜ ਜਾਂਦੇ ਹਨ ਉਹ ਹਰੇਕ ਦੁੱਖ ਸੁੱਖ ਵਿੱਚ ਆਪਣੇ ਸਾਥੀ ਦਾ ਸਾਥ ਦਿੰਦੇ ਹਨ ਇਸ ਦੇ ਨਾਲ ਹੀ ਲੋ ਬੱਚੇ ਜਿੱਤ ਅਤੇ ਹਾਰ ਨੂੰ ਵੀ ਅਪਣਾਉਣਾ ਸਿੱਖ ਜਾਂਦੇ ਹਨ ਉਹਨਾਂ ਨੂੰ ਜਦੋਂ ਵੀ ਆਪਣੀ ਜ਼ਿੰਦਗੀ ਵਿੱਚ ਹਾਰ ਜਾਂ ਜਿੱਤ ਮਿਲਦੀ ਹੈ ਤਾਂ ਉਹ ਇਸ ਤੋਂ ਨਹੀਂ ਡਰਦੇ ਧੰਨਵਾਦ